ਅੱਜ ਦੇ ਸਮੇਂ ਵਿੱਚ ਮੋਬਾਇਲ ਫੋਨ ਅਤੇ ਲੈਪਟਾਪ ਜ਼ਿੰਦਗੀ ਦਾ ਇੱਕ ਹਿੱਸਾ ਬਣ ਚੁੱਕੇ ਹਨ ਜੇਕਰ ਕੋਈ ਟੈਕਨੀਕਲ ਸਮੱਸਿਆ ਆਉਂਦੀ ਹੈ ਤਾਂ ਅਸੀਂ ਅਲੱਗ ਅਲੱਗ ਤਰੀਕਿਆਂ ਦੇ ਨਾਲ ਉਹਦਾ ਹੱਲ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਆਮ ਤੌਰ 'ਤੇ ਜਦੋਂ ਮੋਬਾਇਲ ਲੈਪਟੋਪ ਖਰਾਬੀ ਆਉਂਦੀ ਹੈ ਤਾਂ ਅਸੀਂ ਪਰਿਵਾਰਕ ਮੈਂਬਰਾਂ ਦੋਸਤਾਂ ਜਾਂ ਕਿਸੇ ਜਾਣਕਾਰਾਂ ਤੋਂ ਇਸ ਦੀ ਸਲਾਹ ਲੈਂਦੇ ਹਾਂ ਕੁਛ ਲੋਕ ਗੂਗਲ ਯੂਟਿਊਬ ਅਤੇ ਔਨਲਾਈਨ ਫੋਰਮ ਤੋਂ ਹੱਲ ਲੱਭਣ ਦੀ ਕੋਸ਼ਿਸ਼ ਕਰਦੇ ਹਨ ਜਿਵੇਂ ਕਿ ਕੌਰਾ ਰੈੱਡਇਟ ਜਾਂ ਕੰਪਨੀ ਦੀਆਂ ਸਪੋਰਟਸ ਵੈਬਸਾਈਟਾਂ ਸਰਵਿਸ ਸੈਂਟਰਾਂ ਦੀ ਜਿੱਥੇ ਤੱਕ ਭੂਮਿਕਾ ਹੈ ਜੇਕਰ ਨੋਰਮਲ ਸਮੱਸਿਆ ਹੈ ਤਾਂ ਅਸੀਂ ਅਧਿਆਕ੍ਰਿਕ ਜਾਂ ਨਿੱਜੀ ਸਵਰਿਸ ਸੈਂਟਰਾਂ 'ਤੇ ਜਾਣਾ ਪਸੰਦ ਕਰਦੇ ਹਾਂ ਅਧਿਕਾਰਤ ਸਰਵਿਸ ਸੈਂਟਰ ਜਿਵੇਂ ਕਿ ਐਪਲ ਡੈਲ ਐਚ ਪੀ ਇਹ ਸਾਰੇ ਉੱਚ ਗੁਣਵੱਤਾ ਵਾਲੀਆਂ ਮੁਰੰਮਤ ਸੇਵਾਵਾਂ ਦਿੰਦੇ ਹਨ ਪਰ ਇਹ ਕਾਫੀ ਮਹਿੰਗੀਆਂ ਹੁੰਦੀਆਂ ਹਨ ਦੂਜੇ ਪਾਸੇ ਸਥਾਨਕ ਮੁਰੰਮਤ ਕੇਂਦਰ ਇੱਕ ਸਸਤੇ ਅਤੇ ਤੇਜ਼ ਹੱਲ ਦੀ ਪੇਸ਼ਕਸ਼ ਕਰਦੇ ਹਨ ਪਰ ਉਹਨਾਂ ਦੀ ਵਿਸ਼ਵਾਸ ਯੋਗਤਾ ਅਤੇ ਜੈਨੂਅਨ ਹਿੱਸੇ ਉੱਤੇ ਸਾਨੂੰ ਸ਼ੱਕ ਰਹਿੰਦਾ ਹੈ ਪਿਛਲੇ ਕੁਝ ਸਾਲਾਂ ਵਿੱਚ ਪੰਜਾਬ ਵਿੱਚ ਮੋਬਾਇਲ ਅਤੇ ਲੈਪਟੋਪ ਸਰਵਿਸ ਸੈਂਟਰਾਂ ਦੀ ਗਿਣਤੀ ਵਧੀ ਹੈ ਵੱਡੇ ਸ਼ਹਿਰਾਂ ਜਿਵੇਂ ਕਿ ਲੁਧਿਆਣਾ ਚੰਡੀਗੜ੍ਹ ਅੰਮ੍ਰਿਤਸਰ ਜਲੰਧਰ ਅਤੇ ਪਟਿਆਲਾ ਵਿੱਚ ਬੇਹਤਰੀਨ ਟੈਕਨੋਲੋਜੀ ਮੁਰੰਮਤ ਕੇਂਦਰ ਮੌਜੂਦ ਹਨ ਜਿੱਥੇ ਆਧੁਨਿਕ ਯੰਤਰ ਤਜ਼ਰਬੇਕਾਰ ਟੈਕਨੀਸ਼ੀਅਨ ਅਤੇ ਤੇਜ਼ ਮੁਰੰਮਤ ਸੇਵਾ ਉਪਲਬਧ ਹੈ ਨਵੇਂ ਅਤੇ ਐਪ ਬੇਸ ਸਰਵਿਸ ਜਿਵੇਂ ਕਿ ਅਰਬਨ ਕਲੈਪ ਅਤੇ ਕਉਇਕ ਫਿਕਸ ਪੰਜਾਬ ਵਿੱਚ ਆ ਰਹੀਆਂ ਹਨ ਜੋ ਘਰ ਵਿੱਚ ਮੁਰੰਮਤ ਦੀ ਸੇਵਾ ਦਿੰਦੀਆਂ ਹਨ ਸਥਾਨਕ ਮੁਰੰਮਤ ਸੈਂਟਰਾਂ ਵਿੱਚ ਕੁਆਲਿਟੀ ਅਤੇ ਵਿਸ਼ੇਸ਼ਤਾਵਾਂ ਦੀ ਘਾਟ ਹੁੰਦੀ ਹੈ ਅਧਿਕਾਰਤ ਸਰਵਿਸ ਸੈਂਟਰ ਮਹਿੰਗੇ ਅਤੇ ਹੌਲੀ ਹੋ ਸਕਦੇ ਹਨ ਕਈ ਵਾਰ ਜੈਨੂਅਨ ਪਾਰਟਸ ਦੀ ਉਪਲਬਧਤਾ ਦੀ ਵੀ ਸਮੱਸਿਆ ਆਉਂਦੀ ਹੈ ਬਹੁਤ ਸਾਰੇ ਲੋਕ ਆਪਣੇ ਆਪ ਤਰੀਕਿਆਂ ਉੱਤੇ ਕੰਮ ਕਰਨਾ ਪਸੰਦ ਕਰਦੇ ਹਨ ਕਈ ਵਾਰ ਇਹ ਹੋਰ ਵੀ ਵੱਡੀ ਸਮੱਸਿਆ ਪੈਦਾ ਕਰ ਦਿੰਦਾ ਹੈ ਪੰਜਾਬ ਵਿੱਚ ਮੋਬਾਈਲ ਅਤੇ ਲੈਪਟੋਪ ਮੁਰੰਮਤ ਦੀ ਵਿਆਪਕ ਸੇਵਾ ਉਪਲਬਧ ਹੈ ਪਰ ਉਪਭੋਗਤਾ ਨੂੰ ਵੀ ਚੰਗੀ ਤਕਨੀਕੀ ਜਾਣਕਾਰੀ ਦੀ ਲੋੜ ਹੁੰਦੀ ਹੈ ਜੇਕਰ ਸਰਕਾਰੀ ਅਤੇ ਨਿੱਜੀ ਖੇਤਰ ਵਧੀਆ ਅਤੇ ਵਿਸ਼ਵਾਸਯੋਗ ਟੈਕਨੋਲਜੀ ਸਰਵਿਸ ਸੈਂਟਰ ਖੋਲ੍ਹਣ 'ਤੇ ਧਿਆਨ ਦੇਣ ਤਾਂ ਪੰਜਾਬ ਵਿੱਚ ਮੁਰੰਮਤ ਦੀ ਗੁਣਵੱਤਾ ਹੋਰ ਵਧੀਆ ਹੋ ਸਕਦੀ ਹੈ